ਖੇਡਾਂ ਦੀ ਮੇਰੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਹੈ ਇਹਨਾਂ ਦੇ ਨਾਲ ਹੀ ਮੈਨੂੰ ਸਹਿਨ ਸ਼ਕਤੀ ਆਈ ਹੈ ਅਤੇ ਮਾਨਸਿਕ ਸੰਤੁਲਨ ਸਥਿਰ ਰੱਖਣ ਦੀ ਤਾਕਤ ਮਿਲੀ ਹੈ ਅਤੇ ਇਹਨਾਂ ਦੇ ਨਾਲ ਹੀ ਮੈਨੂੰ ਸਿਹਤ ਤੰਦਰੁਸਤੀ ਮਿਲੀ ਹੈ ਪੰਨਤਾਲੀ ਸਾਲ ਦੀ ਉਮਰ ਵਿੱਚ ਵੀ ਮੈਂ ਆਪਣੀ ਸਿਹਤ ਨੂੰ ਖੇਡਾਂ ਕਰਕੇ ਹੀ ਬਰਕਰਾਰ ਰੱਖਿਆ ਹੋਇਆ ਹੈ ਅਤੇ ਇਹਨਾਂ ਦਾ ਮੇਰੇ ਜੀਵਨ 'ਚ ਵਿੱਚ ਬਹੁਤ ਮਹੱਤਵ ਹੈ